ਸਾਨੂੰ ਉਸ ਸਮੇਂ ਦਾ ਵਰਨਣ ਇਸ ਤਰ੍ਹਾਂ ਹੁੰਦਾ ਹੈ ਅਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ ਜਿਵੇਂ ਕਿ ਕੋਈ ਵੋਟਾਂ ਚੱਲਦੀਆਂ ਨਾ ਉਹਦੇ ਵਿੱਚ ਨਤੀਜੇ ਸਾਰੇ ਆਪਣੇ ਆਪਣੇ ਦਿੰਦੇ ਰਹਿੰਦੇ ਹਨ ਕਿ ਹੁਣ ਇਹ ਅੱਗੇ ਚੱਲ ਰਿਹਾ ਇੰਨੀਆਂ ਸੀਟਾਂ 'ਤੇ ਕੋਈ ਇਹ ਅੱਗੇ ਚੱਲ ਰਿਹਾ ਇੰਨੀਆਂ ਸੀਟਾਂ 'ਤੇ ਸਾਨੂੰ ਇਸ ਤਰ੍ਹਾਂ ਵਿਸ਼ਵਾਸ ਹੀ ਨਹੀਂ ਹੁੰਦਾ ਹੈਗਾ ਵੀ ਇਹ ਕੀ ਚੱਲ ਰਿਹਾ ਵਾ ਸਾਨੂੰ ਉਸ ਟਾਈਮ ਇਹ ਵਿਸ਼ਵਾਸ ਹੁੰਦਾ ਹੈ ਜਦੋਂ ਰਿਜਲਟ ਪੂਰੇ ਨਤੀਜੇ 'ਤੇ ਆਉਂਦਾ ਹੈ ਅਲੱਗ ਅਲੱਗ ਚੈਨਲਾਂ 'ਤੇ ਅਲੱਗ ਅਲੱਗ ਸਿਸਟਮ ਚੱਲਦੇ ਹਨ ਕੋਈ ਉਹਨੂੰ ਅੱਗੇ ਕਰ ਰਿਹਾ ਵਾ ਕੋਈ ਉਹਨੂੰ ਅੱਗੇ ਕਰ ਰਿਹਾ ਵਾ ਕੋਈ ਇੰਨੀਆਂ ਵੋਟਾਂ 'ਤੇ ਆ ਜਿੱਤ ਗਿਆ ਕੋਈ ਇੰਨੀਆਂ ਵੋਟਾਂ 'ਤੇ ਅੱਗੇ ਉਹ ਚਲਾ ਗਿਆ ਇਹੀ ਚੀਜ਼ਾਂ ਸਾਰਾ ਦਿਨ ਚੱਲਦੀਆਂ ਰਹਿੰਦੀਆਂ ਹਨ ਸਾਨੂੰ ਕੇਜਰੀਵਾਲ ਵੀ ਥੋੜ੍ਹਾ ਉਨੀਆਂ ਕੁ ਸੀਟਾਂ 'ਤੇ ਅੱਗੇ ਚਲਾ ਗਿਆ ਕਦੇ ਪਰਮਿੰਦਰ ਸਿੰਘ ਸੋਮਾ ਬੈਂਸ ਸਿਮਰਨਜੀਤ ਸਿੰਘ ਬੈਂਸ ਵੀ ਅੱਗੇ ਇੰਨੀਆਂ ਸੀਟਾਂ 'ਤੇ ਚਲੇ ਗਏ ਕਦੇ ਗੋਲਵਾੜੀ ਇੰਨੀਆਂ ਸੀਟਾਂ 'ਤੇ ਚਲਾ ਗਿਆ ਇਹ ਚੀਜ਼ਾਂ ਸਾਰੀਆਂ ਉਹਦੇ ਵਿੱਚ ਘੁਮਾਉਂਦੇ ਰਹਿੰਦੇ ਹਨ ਪਰ ਅਸਲੀ ਜਿਹੜੇ ਸਾਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਨਤੀਜੇ ਆਉਂਦੇ ਹਨ ਸ਼ਾਮ ਨੂੰ ਤਾਂ ਸਾਰੇ ਉਦੋਂ ਹੀ ਖੁਸ਼ੀ ਮਨਾਉਣੀ ਚਾਹੀਦੀ ਹੈ